ਸਤਿ ਸ਼੍ਰੀ ਅਕਾਲ ਜੀ ਹਾਂਜੀ ਸ਼ਗਨ ਢਾਬੇ ਤੋਂ ਬੋਲਦੇ ਹਾਂਜੀ ਮੈਂ ਨਾ ਤੁਹਾਨੂੰ ਅੱਧਾ ਘੰਟਾ ਪਹਿਲਾਂ ਇੱਕ ਓਡਰ ਦਿੱਤਾ ਸੀ ਰੋਟੀ ਦਾ ਜਿਸ ਵਿੱਚ ਕਿ ਮੈਂ ਰੋਟੀ ਦੇ ਨਾਲ ਤੁਹਾਡੇ ਕੋਲੋਂ ਦੋ ਜੂਸ ਅਤੇ ਦੋ ਠੰਢੇ ਦੀਆਂ ਬੋਤਲਾਂ ਕਿਹਾ ਸੀ ਅਤੇ ਮੈਨੂੰ ਹੁਣ ਉਨ੍ਹਾਂ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਰੋਟੀ ਹੀ ਭੇਜ ਦਿਉ ਰੋਟੀ ਤੁਹਾਡੀ ਬਹੁਤ ਵਧੀਆ ਹੁੰਦੀ ਹੈ ਠੰਢਾ ਵੀ ਹਟਾ ਦਿਉ ਅਤੇ ਜੂਸ ਵੀ ਹਟਾ ਦਿਉ ਅਤੇ ਬ ਇੱਕ ਪਾਣੀ ਦੀ ਬੋਟਲ ਭੇਜ ਦਿਉ